ਹੈਲੋ ਹਾਂਜੀ ਸਰ ਮੈਂ ਅਨੀਤਾ ਬੋਲ ਰਹੀ ਆਂ ਤੇ ਮੈਂ ਹਾਂਜੀ ਮੈਨੂੰ ਇਹ ਜਿਹੜਾ ਨੰਬਰ ਹੈਗਾ ਇਹ ਮੇਰੇ ਕਿਸੇ ਫਰੈਂਡ ਦੇ ਥਰੂ ਪਤਾ ਲੱਗਿਆ ਸੀ ਤੇ ਅਸੀਂ ਬੈਂਗਲੋਰ ਤੋਂ ਆ ਰਹੇ ਆ ਪੰਜਾਬ ਘੁੰਮਣ ਵਾਸਤੇ ਟੂਰਿਸਟ ਪਲੇਸਸ ਦੇ ਮੈਰਿਜ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਨਾ ਇਥੇ ਦੇ ਜਿਹੜੇ ਬਾਰਡਰ ਏਰੀਆ ਉਹ ਵਿਜਿਟ ਕਰਨਾ ਚਾਹੁੰਦੇ ਸੀ ਜੀ ਤੇ ਤੁਸੀਂ ਥੋੜਾ ਜਿਹਾ ਦੱਸੋਗੇ ਕਿ ਵੀ ਇਧਰ ਪਲੇਸਸ ਇੰਟਰਸਟ ਜਿਹੜੇ ਜਿਹੜੇ ਆਪਾਂ ਘੁੰਮ ਸਕਦੇ ਆ ਉਹ ਕਿਹੜੇ ਕਿਹੜੇ ਨੇ ਹਾਂਜੀ ਠੀਕ ਹੈ ਜੀ

ਅੱਛਾ ਜੀ ਅੱਛਾ ਜੀ ਅੱਛਾ ਅਸੀਂ ਅਸੀਂ ਐਟ ਅਸੀਂ ਐਜ਼ ਪ੍ਰੈਜੈਂਟ ਚੰਡੀਗੜ੍ਹ ਹਾਂ ਤੇ ਤੁਸੀਂ ਸਾਨੂੰ ਇਥੋਂ ਕਿਵੇਂ ਕੀ ਪ੍ਰੋਵਾਈਡ ਕਰਾਓਗੇ ਤੇ ਕਿਵੇਂ ਘਮਾਓਗੇ ਥੋੜਾ ਜਿਹਾ ਦੱਸ ਦਿਓ ਅੱਛਾ ਜੀ ਠੀਕ ਹੈ ਜੀ ਤੇ ਸਰ ਆਪਾਂ ਤੁਹਾਡੇ ਟੈਕਸੀ ਚ ਅਸੀਂ ਜੀ ਦੱਸ ਜਾਣਿਆ ਦਾ ਸਾਡਾ ਗਰੁੱਪ ਹੈ ਤੇ ਦੱਸ ਜਾਣਿਆ ਦਾ ਗਰੁੱਪ ਹੈ ਸਾਡਾ ਤੇ ਸਾਨੂੰ ਤੁਸੀਂ ਕਿਹੜੀ ਗੱਡੀ ਪ੍ਰੋਵਾਈਡ ਕਰੋਗੇ ਜਾਂ ਭਾਵੇਂ ਦੋ ਗੱਡੀਆਂ ਹੋ ਜਾਣ ਕੋਈ ਗੱਲ ਨਹੀਂ ਤੇ ਉਹਨਾਂ ਦੇ ਕੀ ਚਾਰਜਸ ਰਹਿਣਗੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਤੁਸੀਂ ਬੋਰਡਿੰਗ ਤੇ ਲੋਜਿੰਗ ਪ੍ਰੋਵਾਈਡ ਕਰਵਾ ਰਹੇ ਨੇ ਤੇ ਅੱਛਾ ਜੀ ਤੇ ਜਿਹੜਾ ਹੈਗਾ ਆਪਣੇ ਕਿੰਨੀ ਕ ਟੋਟਲ ਪੈ ਜਾਏਗਾ ਖਰਚਾ ਮਤਲਬ ਐਸਟੀਮੈਟੇਡ ਅਮਾਊਂਟ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਜੀ ਥੈਂਕਯੂ